ਸਤਿ ਸ਼੍ਰੀ ਅਕਾਲ ਜੀ ਮੈਂ ਐਮਜੋਨ ਐਪ ਤੋਂ ਕਿਚਨਵੀਅਰ ਕਰੋਕਰੀ ਆਰਡਰ ਕੀਤੀ ਸੀ ਮੈਂ ਕਰੋਕਰੀ ਦਸ ਜੂਨ ਨੂੰ ਆਰਡਰ ਕੀਤੀ ਸੀ ਜਿਸ ਦੀ ਡਿਲੀਵਰੀ ਦਾ ਟਾਈਮ ਪੰਦਰ੍ਹਾਂ ਜੂਨ ਤੋਂ ਲੈ ਕੇ ਸਤਾਰ੍ਹਾਂ ਜੂਨ ਦੇ ਵਿੱਚ ਵਿੱਚ ਸੀ ਪਰ ਉਹ ਸਾਡਾ ਆਰਡਰ ਸਾਡੇ ਕੋਲ ਪੱਚੀ ਜੂਨ ਨੂੰ ਡਿਲੀਵਰ ਹੋਇਆ ਸੀ ਜਦੋਂ ਅਸੀਂ ਆਪਣਾ ਪਾਰਸਲ ਖੋਲ੍ਹ ਕੇ ਚੈੱਕ ਕੀਤਾ ਤਾਂ ਸਾਡਾ ਰਿਐਕਸ਼ਨ ਬਹੁਤ ਹੀ ਨਿਰਾਸ਼ਾਵਾਦੀ ਸੀ ਇਸ ਆਰਡਰ ਦੀ ਪੈਕਿੰਗ ਜਮ੍ਹਾਂ ਵੀ ਸਹੀ ਢੰਗ ਨਾਲ ਨਹੀਂ ਕੀਤੀ ਗਈ ਸੀ ਇਸ ਨੂੰ ਇੱਕ ਪੋਲੀਥੀਨ ਵਿੱਚ ਪੈਕ ਕਰਕੇ ਸਾਡੇ ਕੋਲ ਡਿਲੀਵਰ ਕੀਤਾ ਗਿਆ ਸੀ ਜਦੋਂ ਅਸੀਂ ਇਹ ਆਰਡਰ ਖੋਲ੍ਹ ਕੇ ਦੇਖਿਆ ਤਾਂ ਇਸ ਵਿੱਚ ਜੋ ਚੀਜ਼ ਅਸੀਂ ਆਰਡਰ ਕੀਤੀ ਸੀ ਉਹ ਸੇਮ ਕਲਰ ਸੇਮ ਵਰਜ਼ਨ ਦੀ ਨਹੀਂ ਸੀਗੀ ਇਹਨਾਂ ਦੇ ਕਲਰ ਵਿੱਚ ਵੀ ਬਹੁਤ ਜ਼ਿਆਦਾ ਫਰਕ ਸੀ ਹਰੇਕ ਚੀਜ਼ ਅਲੱਗ ਅਲੱਗ ਕਲਰ ਦੀ ਸੀ ਇਹਨਾਂ ਵਿੱਚੋਂ ਕੁਝ ਸਮਾਨ ਟੁੱਟਿਆ ਵੀ ਹੋਇਆ ਸੀਗਾ ਕੁਝ ਕੁ ਵਿੱਚ ਤਰੇੜਾਂ ਪਈਆਂ ਹੋਈਆਂ ਸਨ ਐਵੇਂ ਦਾ ਪਾਰਸਲ ਦੇਖ ਕੇ ਸਾਡਾ ਮਨ ਬਹੁਤ ਹੀ ਦੁਖੀ ਹੋਇਆ ਸੀ ਪਹਿਲਾਂ ਵੀ ਅਸੀਂ ਇਸੇ ਐਪ ਤੋਂ ਹੈਡਫੋਨ ਆਰਡਰ ਕੀਤੇ ਸੀ ਸਾਡੇ ਹੈਡਫੋਨ ਸਾਨੂੰ ਸਹੀ ਟਾਈਮ 'ਤੇ ਸਹੀ ਡੇਟ 'ਤੇ ਸਾਨੂੰ ਡਿਲੀਵਰ ਹੋਏ ਸੀ ਜਿਵੇਂ ਦਾ ਕਲਰ ਅਤੇ ਰੇਟ ਅਸੀਂ ਉੱਥੇ ਐਮਜੋਨ 'ਤੇ ਦੇਖਿਆ ਸੀ ਸਾਨੂੰ ਉਵੇਂ ਹੀ ਹੈਡਫੋਨ ਉਸੇ ਕਲਰ ਅਤੇ ਉਸੇ ਵਰਜ਼ਨ 'ਚ ਮਿਲੇ ਸੀ ਅਸੀਂ ਹੈਡਫੋਨ ਹੈਡਫੋਨਾਂ ਦੀ ਕੁਆਲਟੀ ਬਹੁਤ ਹੀ ਜ਼ਿਆਦਾ ਚੰਗੀ ਸੀਗੀ ਇਹਨਾਂ ਦੀ ਵੋਲੀਅਮ ਵੀ ਬਹੁਤ ਚੰਗੀ ਸੀ ਪਰ ਜਦੋਂ ਅਸੀਂ ਸੈਕਿੰਡ ਪ੍ਰੋਡਕਟ ਆਰਡਰ ਕੀਤਾ ਤਾਂ ਸਾਨੂੰ ਉਹਦੀ ਡਿਲੀਵਰੀ ਇੱਕ ਤਾਂ ਬਹੁਤ ਲੇਟ ਮਿਲੀ ਅਤੇ ਉਹਦਾ ਜਿਹੜਾ ਜਿਹੜੀ ਚੀਜ਼ ਅਸੀਂ ਆਰਡਰ ਕੀਤੀ ਸੀ ਉਹ ਸਹੀ ਢੰਗ ਦੀ ਨਹੀਂ ਨਿਕਲੀ ਸੋ ਤੁਹਾਨੂੰ ਆਹੀ ਰਿਕੁਐਸਟ ਆ ਵੀ ਅੱਗੇ ਤੋਂ ਕੋਈ ਵੀ ਚੀਜ਼ ਡਲੀਵਰ ਕਰਨ ਤੋਂ ਪਹਿਲਾਂ ਉਹਨੂੰ ਚੰਗੀ ਵਰਾਂ ਚੈੱਕ ਕਰਕੇ ਅਤੇ ਸਹੀ ਪੋਲੀਥੀਨ ਜਾਂ ਕਿਸੇ ਚੰਗੀ ਤਰ੍ਹਾਂ ਦੀ ਪੈਕਿੰਗ ਵੇਚੋ ਉਸ ਨੂੰ ਡਿਲੀਵਰ ਕੀਤਾ ਜਾਵੇ ਧੰਨਵਾਦ